ਕੰਮ ਤੋਂ ਬਾਅਦ ਵਿਹਲੇ ਹੋਣ ਤੋਂ ਬਾਅਦ ਮੈਂ ਘਰ ਜਾ ਕੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਵਾ ਜਾਂ ਟੀ ਵੀ ਦੇਖਣ ਦਾ ਮੈਨੂੰ ਬਹੁਤ ਸ਼ੌਂਕ ਆ ਮੋਬਾਈਲ ਵੀ ਮੈਂ ਬਹੁਤ ਜ਼ਿਆਦਾ ਦੇਖਦਾ ਹਾਂ ਮੋਬਾਇਲ ਦੇ ਵਿੱਚ ਮੈਂ ਫੇਸਬੁੱਕ ਦੇ ਵਿੱਚ ਬਹੁਤ ਸਾਰੇ ਵੀਡੀਓ ਦੇਖਦਾ ਰਹਿੰਦਾ ਵਾ ਔਰ ਵੀ ਮੈਨੂੰ ਬੜਾ ਸ਼ੌਂਕ ਹੈ ਜਦੋਂ ਮੈਂ ਫਰੀ ਹੁੰਦਾ ਹਾਂ ਫਰੀ ਹੋਇਆ ਮੈਂ ਪੁਰਾਣੀਆਂ ਪਿਕਚਰਾਂ ਬਹੁਤ ਦੇਖਦਾ ਵਾਂ ਟੀ ਵੀ ਦੇ ਉੱਤੇ ਬਹਿ ਕੇ ਅਤੇ ਔਰ ਮੈਨੂੰ ਘੁੰਮਣ ਦਾ ਸ਼ੌਂਕ ਤਾਂ ਹੈਗਾ ਹੀ ਹੈ ਔਰ ਅਸੀਂ ਸੰਡੇ ਦੇ ਦਿਨ ਸੋਚੀ ਦਾ ਕਿੱਥੇ ਜਾਈਏ ਬੱਚਿਆਂ ਨੂੰ ਲੈ ਕੇ ਚਲ ਜਾਈ ਦਾ ਮਾਰਕੀਟ ਚਲੇ ਗਏ ਖਾਧਾ ਪੀਤਾ ਫਿਰ ਆ ਗਏ ਫਿਰ ਕੋਈ ਨਾ ਕੋਈ ਪਲਾਨ ਕਰੀਦਾ ਕਿ ਹੋਰ ਅਗਲੇ ਸੰਡੇ ਅਸੀਂ ਕਿੱਥੇ ਜਾਵਾਂਗੇ ਘੁੰਮਣ ਅਤੇ ਘੁੰਮਣ ਵਾਸਤੇ ਕੋਈ ਨਾ ਕੋਈ ਜਗ੍ਹਾ ਜ਼ਰੂਰ ਸਿਲੈਕਟ ਕਰ ਲਈ ਦੀ ਹੈ ਜਿੱਥੇ ਅਸੀਂ ਘੁੰਮਣ ਜਾ ਸਕੀਏ ਔਰ ਮੈਂ ਕੀ ਕਹਿੰਦੇ ਆ ਬਾਹਰ ਘੁੰਮਣ ਦਾ ਮੈਨੂੰ ਬਹੁਤ ਸ਼ੌਂਕ ਹੈ ਅਗਰ ਜਾਣਾ ਹੋਵੇ ਤਾਂ ਮੈਂ ਮਤਲਬ ਕਿ ਦਿੱਲੀ ਔਰ ਦਿੱਲੀ ਔਰ ਨੋਇਡਾ ਵਿੱਚ ਘੁੰਮਣ ਦਾ ਬਹੁਤ ਸ਼ੌਕੀਨ ਹਾਂ ਦਿੱਲੀ ਔਰ ਨੋਇਡਾ 'ਚ ਘੁੰਮਣ ਦਾ ਬਹੁਤ ਸ਼ੌਕੀਨ ਆ ਇੱਥੇ ਵੀ ਅਸੀਂ ਕਦੀ ਨਾ ਕਦੀ ਆਪਣੇ ਘਰ ਦੇ ਕੋਲ ਸਾਡੇ ਇੱਥੇ ਮੌਲ ਹੈਗਾ ਉੱਥੇ ਘੁੰਮਣ ਚਲ ਜਾਈਦਾ ਬੱਚਿਆਂ ਨੂੰ ਘੁਮਾ ਲਿਆਈਦਾ ਜਾ ਕੇ ਔਰ ਉੱਥੇ ਤਰ੍ਹਾਂ ਤਰ੍ਹਾਂ ਦੇ ਸ਼ੋਅਰੂਮ ਖੁੱਲ੍ਹੇ ਆ ਉੱਥੇ ਜਾ ਕੇ ਕੋਈ ਨਾ ਵਿੰਡੋ ਸ਼ੋਪਿੰਗ ਕਰ ਲਈ ਜਾਂ ਕੁਛ ਆਪਣੇ ਲਾਇਕ ਕੁਛ ਮਿਲ ਗਿਆ ਤਾਂ ਖਰੀਦ ਲਿਆ